ਘੋੜ ਸਵਾਰੀ ਲਈ ਸਰੀਰ ਮਾਨਸਿਕ ਤੌਰ 'ਤੇ ਸਰੀਰਕ ਪੱਖੋਂ ਮਜ਼ਬੂਤ ਹੋਣਾ ਚਾਹੀਦਾ ਹੈ ਕਿਉਂਕਿ ਕਈ ਵਾਰੀ ਘੋੜਾ ਬੇਕਾਬੂ ਹੋ ਜਾਂਦਾ ਹੈ ਉਸਨੂੰ ਸਾਂਭਣ ਲਈ ਸਰੀਰਕ ਫੁਰਤੀ ਹੋਣੀ ਬਹੁਤ ਜ਼ਰੂਰੀ ਹੈ ਇਸ ਲਈ ਮੈਂ ਅਜਿਹੀਆਂ ਕਸਰਤਾਂ ਬਾਰੇ ਦੱਸਣਾ ਚਾਹੁੰਦਾ ਹਾਂ ਜਿਸ ਵਿੱਚ ਸਰੀਰ ਵਿੱਚ ਤਾਕਤ ਆਵੇ ਸਰੀਰ ਫੁਰਤੀਲਾ ਬਣੇ ਆਦਿ ਜਿਵੇਂ ਗਰਾਊਂਡ ਵਿੱਚ ਜਾ ਕੇ ਦੌੜਨਾ ਸਰੀਰ ਦਾ ਲਚਕੀਲਾਪਣ ਵਧਾਉਣ ਦੀ ਕਸਰਤ ਕਰਨੀ ਚਾਹੀਦੀ ਹੈ